ਪਿਛਲੇ ਹਫ਼ਤੇ ਮੈਂ ਔਨਲਾਈਨ ਐਮਾਜੋਨ ਤੋਂ ਡਿਨਰ ਸੈੱਟ ਮੰਗਵਾਇਆ ਸੀ ਦੋ ਹਜ਼ਾਰ ਰੁਪਈਏ ਦਾ ਉਹ ਜਦੋਂ ਘਰ ਆਇਆ ਡਿਨਰ ਸੈੱਟ ਤਾਂ ਖੋਲ੍ਹ ਕੇ ਦੇਖਿਆ ਉਹ ਕਈ ਕਲੇ ਕਈ ਪਲੇਟਾਂ ਉਹਦੇ ਵਿੱਚ ਖਰਾਬ ਨਿੱਕਲੀਆਂ ਅਤੇ ਬਿਲਕੁਲ ਵੀ ਚੰਗਾ ਨਹੀਂ ਨਿਕਲਿਆ ਮੈਂ ਇਹੀ ਚਾਂ ਕਹਿਣਾ ਚਾਹੁੰਦੀ ਹਾਂ ਵੀ ਕੋਈ ਵੀ ਔਨਲਾਈਨ ਚੀਜ਼ ਨਾ ਮੰਗਵਾਓ ਜਿਹਨੇ ਲੈਣੀ ਏ ਚੀਜ਼ ਬਜ਼ਾਰ ਜਾ ਕੇ ਦੁਕਾਨ ਤੋਂ ਦੇਖ ਕੇ ਲੈ ਕੇ ਆਓ ਔਨਲਾਈਨ ਚੀਜ਼ਾਂ ਬਿਲਕੁਲ ਵੀ ਚੰਗੀਆਂ ਨਹੀਂ ਨਿਕਲ਼ਦੀਆਂ